ਮੈਮ ਮੈਂ ਇੱਥੇ ਇੱਕ ਕਾਰ ਖਰੀਦਣ ਲਈ ਕਾਲ ਕੀਤੀ ਹੈ ਕੀ ਤੁਸੀਂ ਮੈਨੂੰ ਇਸ ਵਿੱਚ ਕਰ ਸਕਦੇ ਹੋ ਜੀ ਤੁਸੀਂ ਡਿਜ਼ਾਇਰ ਜਾਂ ਫਿਰ ਸਵਿਫਟ ਬਾਰੇ ਸੰਖੇਪ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਮੈਂ ਫੈਸਲਾ ਕਰ ਸਕਾਂ ਕਿ ਮੈਂ ਕਿਸ ਲਈ ਚਾਹੁੰਦਾ ਹਾਂ ਮੈਨੂੰ ਵੀ ਐਕਸ ਆਈ ਵਿਸ਼ੇਸ਼ਤਾ ਬਾਰੇ ਦੱਸੋਗੇ ਥੋੜ੍ਹਾ ਜਿਹਾ ਇਸਦੀ ਕੀਮਤ ਕਿੰਨੀ ਕੁ ਹੋਵੇਗੀ ਅਤੇ ਤੁਸੀਂ ਮੈਨੂੰ ਸੀਆਜ਼ ਬਾਰੇ ਵੀ ਦੱਸ ਸਕਦੇ ਆ ਅਤੇ ਇਸ ਦੀਆਂ ਔਨ ਰੋਡ ਕੀਮਤ ਕਿੰਨੀ ਕੁ ਹੋਜੂਗੀ ਅੱਛਾ ਮੈਂ ਸਿਆਜ ਲੈਣਾ ਚਾਵਾਂਗਾ ਜੀ ਮੈਂ ਚੈੱਕ ਦੁਆਰਾ ਭੁਗਤਾਨ ਕਰ ਸਕਦਾ ਹਾਂ ਠੀਕ ਹੈ ਜੀ ਮੈਂ ਥੋ ਜਦੋਂ ਆਵਾਂਗਾ ਉਦੋਂ ਤੁਹਾਨੂੰ ਚੈੱਕ ਦੇ ਦੇਵਾਂਗਾ ਉਸ ਤੋਂ ਬਾਅਦ ਮੈਂ ਆਪਣੀ ਕਾਰ ਰਸੀਵ ਕਰ ਲਾਂਗਾ ਜੀ ਧੰਨਵਾਦ ਜੀ ਤੁਹਾਡੀ ਮਦਦ ਲਈ